ਹੈਲੋ ਹਾਂਜੀ ਅੱਛਾ ਸਰ ਅਸੀਂ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਜਿਸ ਤਰ੍ਹਾਂ ਕਿ ਅਸੀਂ ਨਾ ਤੁਹਾਡੀ ਜੇ ਟੈਕਸੀ ਬੁੱਕ ਕੀਤੀ ਸੀ ਅਸੀਂ ਦੇਖਿਆ ਇਹ ਮੈਂ ਕੰਪਲੇਂਟ ਕਰਨਾ ਚਾਹੁੰਦੀ ਹਾਂ ਜਿਹਦੇ ਨਾਲ਼ ਮੈਨੂੰ ਬਹੁਤ ਦਿੱਕਤਾਂ ਦਾ ਸਾਹਮਣਾ ਹੋਇਆ ਤੁਸੀਂ ਇਹ ਡਰਾਈਵਰ ਭੇਜਿਆ ਸੀ ਜਿਸ ਤਰ੍ਹਾਂ ਕਿਤੇ ਤੁਸੀਂ ਇਹ ਡਰਾਈਵਰ ਭੇਜਿਆ ਸੀ ਇਹ ਬਿਲਕੁਲ ਠੀਕ ਤੁਹਾਡੀ ਮੈਨੂੰ ਇਹ ਰੀਵਿਊ ਇਹਦਾ ਠੀਕ ਨਹੀਂ ਹੈਗੇ ਜਿਸ ਤਰ੍ਹਾਂ ਕਿ ਮੈਂ ਦੇਖਿਆ ਕਿ ਮੈਂ ਜਿਹੜੀ ਡਰਾਈਵ ਕੀਤੀ ਅਤੇ ਮੈਨੇ ਬੁੱਕ ਕੀਤੀ ਆਪਣੀ ਟੈਕਸੀ ਬੁੱਕ ਕੀਤੀ ਤਾਂ ਦੇਖਿਆ ਮੈਨੇ ਕਿ ਇਹਨਾਂ ਦੇ ਇਹ ਜਿਹੜਾ ਪਹਿਲੇ ਤਾਂ ਜਾਂਦੇ ਹੀ ਇਹਨਾਂ ਦਾ ਏਸੀ ਹੀ ਨਹੀਂ ਔਨ ਸੀ ਅਤੇ ਜਦੋਂ ਏਸੀ ਔਨ ਦੀ ਗੱਲ ਕੀਤੀ ਗਈ ਤਾਂ ਫਿਰ ਇਹਨਾਂ ਵੱਲੋਂ ਏਸੀ ਔਨ ਨਹੀਂ ਕੀਤਾ ਗਿਆ ਫਿਰ ਇਹ ਕਹਿ ਕੇ ਬੰਦ ਕਰ ਦਿੱਤਾ ਕਿ ਚੱਲੋ ਏਸੀ ਠੀਕ ਨਹੀਂ ਹੈ ਤਾਂ ਵਿੰਡੋ ਖੋਲ੍ਹ ਦਿੱਤੀਆਂ ਏਨੀ ਗਰਮੀ ਦੇ ਸੀਜ਼ਨ ਵਿੱਚ ਏਸੀ ਔਫ਼ ਹੋਣਾ ਬਹੁਤ ਮੁਸ਼ਕਿਲ ਦੀ ਗੱਲ ਹੈਗੀ ਹੈ ਸਫ਼ਰ ਕਰਨਾ ਬੜਾ ਮੁਸ਼ਕਿਲ ਹੋ ਜਾਂਦਾ ਹੈ ਦੂਸਰਾ ਜਿਹੜਾ ਹੈਗਾ ਰਸਤੇ ਵਿੱਚ ਜਾਂਦੇ ਹੋਏ ਸਾਨੂੰ ਬੜੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਟ੍ਰੈਫਿਕ ਸੀ ਉਹ ਐਸੇ ਰਸਤੇ ਵਿੱਚ ਲੈ ਕੇ ਗਿਆ ਜਿੱਥੇ ਟ੍ਰੈਫਿਕ ਬਹੁਤ ਜ਼ਿਆਦਾ ਸੀ ਇਹਦੇ ਸੰਬੰਧ ਵਿੱਚ ਤੁਸੀਂ ਕੀ ਕਹਿਣਾ ਚਾਹੌਂਗੇ ਹੁਣ ਦੇਖੋ ਅਸੀਂ ਤੁਹਾਡੀ ਕੰਪਨੀ ਉੱਤੇ ਬੜਾ ਬਿਲੀਵ ਕਰਕੇ ਇਹ ਜਿਹੜਾ ਹੈਗਾ ਬੁੱਕ ਕੀਤੀ ਸੀ ਰਾਈਡ ਪਰ ਇੰਨੀ ਦਿੱਕਤਾਂ ਦਾ ਜਿਹੜਾ ਸਾਹਮਣਾ ਕਰਨਾ ਪਿਆ ਔਰ ਲੌਂਗ ਰੂਟ ਦੀ ਤਰਫ਼ ਗਿਆ ਲੌਂਗ ਰੂਟ ਦੀ ਤਰਫ਼ ਗਿਆ ਅਤੇ ਸਾਨੂੰ ਜਿਹੜਾ ਟ੍ਰੈਫਿਕ ਵਿੱਚ ਵੜਨਾ ਪਿਆ ਏ ਸੀ ਨਹੀਂ ਚੱਲਦਾ ਸੀ ਉਹਦਾ ਬੀਹੇਵੀਅਰ ਵੀ ਸਾਨੂੰ ਕੁਝ ਜ਼ਿਆਦਾ ਅੱਛਾ ਨਹੀਂ ਲੱਗਿਆ ਨਹੀਂ ਅੱਗੇ ਤੋਂ ਤੁਹਾਨੂੰ ਹੀ ਧਿਆਨ ਰੱਖਣਾ ਪਵੇਗਾ ਕਿਉਂਕਿ ਇੰਝ ਹਰ ਕਿਸੀ ਇਨਸਾਨ ਨਾਲ਼ ਇੰਨਾ ਗਲਤ ਨਾ ਹੋਵੇ ਕਿਉਂਕਿ ਉਹ ਸਫ਼ਰ ਹੀ ਹੈ ਜਿਹੜਾ ਹੈਗਾ ਕਿ ਉਹ ਅੱਛਾ ਦਿਖਾਉਣਾ ਚਾਹੁੰਦਾ ਹੈ ਚਲੋ ਅੱਗੇ ਤੋਂ ਧਿਆਨ ਰੱਖਿਆ ਜਾਵੇ ਇਹੀ ਕਹੂੰਗੀ